ਮੇਰਾ ਫੇਵਰਟ ਪਕਵਾਨ ਚੋਕਲੇਟ ਹੈ ਅਤੇ ਮੈਂ ਉਸਨੂੰ ਬਚਪਨ ਤੋਂ ਹੀ ਸਭ ਤੋਂ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਮੈਨੂੰ ਉਹਦਾ ਸਵਾਦ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਅਤੇ ਪ੍ਰਭਾਵਿਤ ਵੀ ਕਰਦਾ ਹੈ ਜਦ ਵੀ ਮੇਰੀ ਤਬੀਅਤ ਠੀਕ ਨਹੀਂ ਹੁੰਦੀ ਅਤੇ ਮੈਂ ਆਪਣੀ ਫੇਵਰੇਟ ਪਕਵਾਨ ਨੂੰ ਛੱਕਦੀ ਹਾਂ ਤਾਂ ਮੇਰਾ ਇੱਕ ਤਾਂ ਮੂਡ ਵੀ ਸਹੀ ਹੋ ਜਾਂਦਾ ਹੈ ਅਤੇ ਨਾਲੇ ਮੇਰੀ ਤਬੀਅਤ ਵਿੱਚ ਵੀ ਮੈਨੂੰ ਸੁਧਾਰ ਦਿਖਦਾ ਹੈ ਕਿਉਂਕਿ ਜੇ ਸਾਡਾ ਮਨ ਖੁਸ਼ ਹੋਵੇਗਾ ਤਾਂ ਹੀ ਸਾਡਾ ਸਰੀਰ ਅਤੇ ਤਨ ਵੀ ਸਹੀ ਰਵੇਗਾ